ਥੋੜ੍ਹੇ ਕੁ ਦਿਨ ਪਹਿਲਾਂ ਦੀ ਗੱਲ ਹੈ ਮੈਂ ਫਲਿਪਕਾਰਟ ਤੋਂ ਆਪਣੇ ਫੋਨ ਦਾ ਚਾਰਜਰ ਔਡਰ ਕੀਤਾ ਸੀਗਾ ਅਤੇ ਉਹ ਫਾਈਵ ਟੂ ਸੈਵਨ ਵਰਕਿੰਗ ਡੇਜ਼ ਦੇ ਵਿੱਚ ਚਾਰਜਰ ਆ ਗਿਆ ਸੀ ਪਹਿਲਾਂ ਤਾਂ ਮੈਂ ਵਰਿਡ ਸੀ ਕਿ ਚਾਰਜਰ ਇਲੈਕਟ੍ਰੋਨਿਕਸ ਚੀਜ਼ ਆ ਉਸ ਨੂੰ ਮੈਂ ਕਰਾਂ ਔਡਰ ਕਿ ਨਾ ਔਡਰ ਕਰਾਂ ਫਿਰ ਮੈਂ ਕਿਹਾ ਚੱਲ ਕਰ ਲੈਂਦੀ ਹਾਂ ਬਿਕੋਸ ਉੱਥੇ ਟੈੱਨ ਡੇਜ਼ ਦੀ ਰਿਫੰਡ ਪੋਲਿਸੀ ਸੀਗੀ ਤਾਂ ਕਰਕੇ ਫਿਰ ਮੈਨੇ ਨਾ ਔਡਰ ਕਰਤਾ ਅਤੇ ਜਦੋਂ ਸੱਤ ਕੁ ਦਿਨਾਂ ਦੇ ਵਿੱਚ ਉਹ ਆਇਆ ਚਾਰਜਰ ਪੇਮੈਂਟ ਤਾਂ ਮੈਂ ਪਹਿਲਾਂ ਹੀ ਔਨਲਾਈਨ ਕਰਤੀ ਸੀ ਕਿਉਂਕਿ ਫਿਫਟੀਨ ਰੁਪੀਸ ਉਸ 'ਤੇ ਲੈਸ ਹੁੰਦੇ ਹੈ ਅਤੇ ਉਹ ਐਵੇਂ ਸੀਗਾ ਵੀ ਢਾਈ ਸੌ ਰੁਪਏ ਦਾ ਸੀਗਾ ਅਤੇ ਮੈਨੂੰ ਦੋ ਸੌ ਪੰਨਤਾਲੀ ਦੋ ਸੌ ਪੈਂਤੀ ਰੁਪਏ ਦਾ ਪੈ ਗਿਆ ਸੀਗਾ ਚਾਰਜਰ ਅਤੇ ਫਿਰ ਜਦੋਂ ਚਾਰਜਰ ਆਇਆ ਮੈਂ ਓਪਨ ਓਪਨ ਕਰਨ ਲਈ ਵੀ ਵਰਿਡ ਸੀਗੀ ਵੀ ਹਾਂ ਬਈ ਪਤਾ ਨਹੀਂ ਕਿੱਦਾਂ ਦਾ ਹੋਵੇਗਾ ਇਲੈਕਟ੍ਰੋਨਿਕਸ ਕਦੇ ਮੈਂ ਪਹਿਲਾਂ ਪਰਚੇਜ ਨਹੀਂ ਕਰਿਆ ਸੀਗਾ ਔਨਲਾਈਨ ਐਪ ਤੋਂ ਖੁਦ ਔਫ ਔਫਲਾਈਨ ਹੀ ਪਰਚੇਜ ਕੀਤਾ ਸੀ ਫੋਨ ਦੇ ਨਾਲ ਹੀ ਫਿਰ ਜਦੋਂ ਮੈਂ ਚਾਰਜਰ ਖੋਲਿਆ ਫਿਰ ਮੈਨੂੰ ਇਹ ਵੀ ਸੀਗਾ ਵੀ ਪੱਕਾ ਇਹ ਘੱਟ ਵੋਟ ਦਾ ਹੋਏਗਾ ਅਤੇ ਚਾਰਜਿੰਗ ਘੱਟ ਕਰੇਗਾ ਫਿਰ ਮੈਨੇ ਉਸਨੂੰ ਟਰਾਏ ਕਰਨ ਲਈ ਆਪਣੇ ਫੋਨ ਦੀ ਬੈਟਰੀ ਟੈੱਨ ਪਰਸੈਂਟ 'ਤੇ ਚਾਰਜ ਲਗਾਈ ਚਾਰਜ ਚਾਰਜ ਕਰਨਾ ਸ਼ੁਰੂ ਕੀਤਾ ਅਤੇ ਜਦੋਂ ਮੈਂ ਦੇਖਿਆ ਇ ਇੰਨਾ ਫਾਸਟ ਚਾਰਜਰ ਸੀ ਉਹ ਬਹੁਤ ਜ਼ਿਆਦਾ ਵਧੀਆ ਮਤਲਬ ਇੰਨਾ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਉਸਦਾ ਪ੍ਰੋਡਕਟ ਰਿਵਿਊ ਉਹ ਮੈਨੇ ਬਿਲਕੁਲ ਫਾਈਵ ਸਟਾਰ ਕੀਤਾ ਕਿਉਂਕਿ ਲਗਭਗ ਇੱਕ ਘੰਟਾ ਪੰਨਤਾਲੀ ਮਿੰਟ ਦੇ ਵਿੱਚ ਮੇਰਾ ਫੋਨ ਨਾਈਨਟੀ ਏਟ ਪਰਸੈਂਟ ਚਾਰਜ ਹੋ ਗਿਆ ਸੀ ਮਤਲਬ ਬਿਲਕੁਲ ਵੇਸਟੇਜ ਨਹੀਂ ਹੋਈ ਟਾਈਮ ਦੀ ਵੀ ਨਹੀਂ ਤਾਂ ਚਾਰਜਰ ਹੁੰਦੇ ਆ ਦੋ ਦੋ ਤਿੰਨ ਤਿੰਨ ਘੰਟੇ ਬੈਠੇ ਰਹੋ ਚਾਰਜ ਹੀ ਨਹੀਂ ਹੁੰਦਾ ਫੋਨ ਪਰ ਉਹ ਮਤਲਬ ਜਿਹੜਾ ਫੋਨ ਹੈ ਉਹ ਇੰਨੀ ਅੱਛੀ ਤਰ੍ਹਾਂ ਚਾਰਜ ਹੋ ਗਿਆ ਅਤੇ ਕਾਫ਼ੀ ਅੱਛਾ ਚਾਰਜਰ ਸੀਗਾ ਮਤਲਬ ਹਾਈਵੋਟ ਵਾਲਾ ਸੀਗਾ ਅਤੇ ਕਾਫ਼ੀ ਅੱਛਾ ਰਿਹਾ ਮੇਰਾ ਐਕਸਪੀਰੀਅੰਸ ਚਾਰਜਰ ਦਾ ਇਲੈਕਟ੍ਰੋਨਿਕਸ ਦਾ ਔਨਲਾਈਨ ਥੈਂਕ ਯੂ